ਭਾਰਤ ਦੀ ਭਾਰਤ ਦੀਆਂ ਕਾਫ਼ੀ ਕਲਾਵਾਂ ਕੁਛ ਹੈਗੀਆਂ ਸ਼ੀਲਾਂ ਹੈਗੀਆਂ ਜਿਹੜੀਆਂ ਅਲੋਪ ਹੁੰਦੀਆਂ ਪਈਆਂ ਜਿਵੇਂ ਹੱਥ ਦਾ ਹੱਥ ਨਾਲ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਘੜੇ ਹੋ ਗਏ ਘੜੇ ਐਨੇ ਵਧੀਆ ਚੀਜ਼ਾਂ ਸੀਗੀਆਂ ਜਿਨ੍ਹਾਂ ਨਾਲ ਸਾਨੂੰ ਫਰਿੱਜ ਵਗੈਰਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ ਅਸੀਂ ਬਸ ਘੜੇ ਵਿੱਚ ਪਾਣੀ ਪਾ ਕੇ ਰੱਖ ਦਿਉ ਅਤੇ ਕੁਛ ਦੇਰ ਬਾਅਦ ਉਹ ਆਪ ਹੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਸੀਗਾ ਜਿਹੜਾ ਨੈ ਜਿਹੜਾ ਜਿਹੜਾ ਜਿਹੜਾ ਕਿ ਨੈਚੁਰਲ ਵੇਅ ਹੈਗਾ ਸਾਰਾ ਕੁਛ ਕਰਨ ਦਾ ਅਤੇ ਪਰ ਇਨ੍ਹਾਂ ਚੀਜ਼ਾਂ ਨੂੰ ਟੈਮ ਲੱਗਦਾ ਵਗੈਰਾ ਲੱਗਦਾ ਅਤੇ ਇਹ ਸਾਰਾ ਜਿੱਦਾਂ ਫਰਿੱਜ ਮਸ਼ੀਨ ਹੈਗੀ ਮਿੰਟਾਂ ਮ ਸਕਿੰਟਾਂ ਵਿੱਚ ਜਿੱਦਾਂ ਠੰਡੀ ਕਰ ਦਿੰਦੀ ਆ ਚੀਜ਼ਾਂ ਨੂੰ ਪਰ ਘੜਿਆਂ ਨੂੰ ਟੈਮ ਲੱਗਦਾ ਕਰਨ ਵਾਸਤੇ ਤਾਂ ਉਹ ਚੀਜ਼ਾਂ ਥੋੜ੍ਹੀਆਂ ਮਾੜੀਆਂ ਨਾ ਲੋਕ ਵਰਤਣੋਂ ਡਰਦੇ ਹੈਗੇ ਅਤੇ ਨਾ ਯੂਜ ਨਹੀਂ ਕਰਦੇ ਹੈਗੇ ਅਤੇ ਉਹੀ ਚੀਜ਼ਾਂ ਹੈਗੀਆਂ ਜਿਹੜੀਆਂ ਨਾਲ ਨਾਲ ਅਲੋਪ ਹੁੰਦੀਆਂ ਪਈਆਂ ਵਾਂ ਅਤੇ ਹੋਰ ਹੋ ਗਿਆ ਕਲਾਕਾਰੀ ਹੋ ਗਈ ਹੱਥਾਂ ਨਾਲ ਕੀਤੀ ਹੋਈ ਇਹਨਾਂ ਚੀਜ਼ਾਂ ਨੂੰ ਬਣਨ ਲਈ ਨਾ ਟਾਈਮ ਜ਼ਿਆਦਾ ਲੱਗਦਾ ਵਾ ਅਤੇ ਮਸ਼ੀਨਾਂ ਵਿੱਚ ਮਿੰਟਾਂ ਸਕਿੰਟਾਂ ਵਿੱਚ ਬਣਦੀਆਂ ਹੈਗੀਆਂ ਅਤੇ ਤਾਂ ਹੀ ਉਨ੍ਹਾਂ ਦੀ ਵੈਲਿਊ ਵੀ ਘੱਟ ਜਾਂਦੀ ਹੈ ਅਤੇ ਹੱਥਾਂ ਨਾਲ ਬਣਿਆ ਬਣੀਆਂ ਚੀਜ਼ਾਂ ਦੀ ਨਾ ਵੈਲਿਊ ਵੀ ਹੋਰ ਹੈਗੀ ਪਰ ਟਾਈਮ ਵੀ ਓਨਾ ਹੀ ਲੈਂਦੀਆਂ ਵਾਂ ਚੀਜ਼ਾਂ ਚੱਲਦੀਆਂ ਬਹੁਤ ਦੇਰ ਦੇਰ ਤੱਕ ਹੈਗੀਆਂ ਪਰ ਲੋਕ ਖਰੀਦਣ ਤੋਂ ਡਰਦੇ ਹੈ ਕਿਉਂਕਿ ਉਹ ਚੀਜ਼ਾਂ ਕੀ ਆ ਟੈਮ ਲੈਂਦੀਆਂ ਹਨ ਅਤੇ ਮਹਿੰਗੀ ਬਹੁਤ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਮਾੜਾ ਜਿਹਾ ਸਸਤਾ ਕਰਕੇ ਜਾਂ ਕਰਕੇ ਸਾਨੂੰ ਫਿਰ ਵੀ ਉਨ੍ਹਾਂ ਨੂੰ ਰੱਖਣਾ ਚਾਹੀਦਾ ਵਾ ਕਿਉਂਕਿ ਸਾਡਾ ਸੱਭਿਆਚਾਰ ਹੈਗਾ ਸਾਡਾ ਕਲਚਰ ਹੈਗਾ ਸਾਡਾ ਪੁਰਾਣੀਆਂ ਚੀਜ਼ਾਂ ਕਿ ਜਿਨ੍ਹਾਂ ਨੂੰ ਹਾਲੇ ਵੀ ਬਚਾਉਣਾ ਚਾਹੀਦਾ ਵਾ